ਹਾਂਜੀ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਟੈਕਨੋਲਜੀ ਦਾ ਯੰਤਰ ਗੂਗਲ ਨੈਸਟ ਜਾਂ ਐਮਜੋਨ ਜੋ ਕਿ ਇੱਕੋ ਵਰਗੇ ਵੋਇਸ ਨ ਵੋਇਸ ਨਿਯੰਤਰਣ ਹੋਮ ਅਸਿਸਟੈਂਟ ਹਨ ਵੋਇਸ ਇਹਨਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਵੋਇਸ ਜਿਹੜੇ ਗੂਗਲ ਨੈਸਟ ਜਾਂ ਵੋਇਸ ਨਿਯੰਤਰਣ ਵਾਲੇ ਉਪਕਰਨ ਹਨ ਇਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਹੋਣ ਲੱਗ ਪਈ ਹੈ ਜਿਵੇਂ ਆਈਫੋਨ ਦੇ ਵਿੱਚ ਹੋ ਗਿਆ ਜਾਂ ਆਪਾਂ ਗੂਗਲ ਨੈਸ ਦੀ ਗੱਲ ਕਰੀਏ ਆਪਾਂ ਕੁਛ ਵੀ ਬੋਲ ਕੇ ਕੋਈ ਵੀ ਆਪਾਂ ਉਹਨਾਂ ਨੂੰ ਬੋਲ ਕੇ ਕੁਛ ਵੀ ਕਹੀਏ ਜਿਵੇਂ ਆਪਾਂ ਕੋਈ ਫੋਟੋਜ ਦੇਖਣਾ ਚਾਹੁੰਦੇ ਹਾਂ ਜਾਂ ਪੁਰਾਣੀਆਂ ਫੋਟੋਜ ਦੇਖਣਾ ਚਾਹੁੰਦੇ ਹਾਂ ਜਾਂ ਆਪਾਂ ਕੋਈ ਵੀ ਆਪਣਾ ਪ੍ਰੋਡਕਟ ਖਰੀਦਣਾ ਚਾਹੁੰਦੇ ਹਾਂ ਆਪਾਂ ਕੁਛ ਵੀ ਬੋਲੀਏ ਉਹ ਨਾਲ ਨਾਲ ਆਪਣਾ ਸ਼ੋ ਰਿਜਲਟ ਕਰ ਦਿੰਦਾ ਜੇਕਰ ਕੋਈ ਘੱਟ ਪੜ੍ਹਿਆ ਲਿਖਿਆ ਬੰਦਾ ਜਿਹਨੂੰ ਲਿਖਣਾ ਘੱਟ ਆਉਂਦਾ ਤਾਂ ਉਹਦੇ ਲਈ ਗੂਗਲ ਨੈਸਟ ਜਾਂ ਵੋਇਸ ਜਿਹੜੇ ਨਿਯੰਤਰਣ ਆ ਉਹ ਬਹੁਤ ਕਾਮਯਾਬ ਕਾਰਗਰ ਸਾਬਤ ਹੁੰਦੇ ਹਨ ਇਹ ਜਿਹੜੇ ਵੋਇਸ ਨਿਯੰਤਰਣ ਹੈ ਇਹ ਹਰ ਇੱਕ ਐਪ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੇ ਹਨ ਜਿਵੇਂ ਕਿ ਯੂਟੀਊਬ ਲਾ ਲਓ ਠੀਕ ਹੈ ਅਤੇ ਬਟ ਜਿਹੜਾ ਗੂਗਲ ਨੈਸਟ ਹੈ ਇਹਦੇ 'ਚ ਆਪਾਂ ਆਪਣੇ ਪ੍ਰੋਡਕਟ ਵਗੈਰਾ ਵੀ ਜੋ ਵੀ ਆਪਾਂ ਨੂੰ ਚੀਜ਼ ਚਾਹੀਦੀ ਜਿਵੇਂ ਹੋਮ ਅਪਲਾਇੰਸ ਚਾਹੀਦੇ ਆ ਇਲੈਕਟਰੋਨਿਕਸ ਚਾਹੀਦਾ ਉਹ ਜੋ ਵੀ ਚੀਜ਼ ਆਪਾਂ ਬੋਲ ਕੇ ਠੀਕ ਹੈ ਕ ਕਰ ਸਕਦੇ ਹਾਂ ਐਮਜੋਨ ਦੇ ਵਿੱਚ ਵੀ ਆਪਾਂ ਜੇਕਰ ਆਪਾਂ ਗੂਗਲ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਗੂਗਲ ਐਮਾਜੋਨ ਦੇ ਵਿੱਚੋਂ ਕ ਕਈ ਵਾਰ ਜਿਹੜਾ ਵੋਇਸ ਨਿਯੰਤਰਣ ਯੂਜ ਕੀਤਾ ਆਪਣਾ ਕ ਕਈ ਵਾਰ ਕੋਈ ਮੇਰਾ ਦੋਸਤ ਹੁੰਦਾ ਸੀ ਉਹ ਮੈਨੂੰ ਕੋਈ ਚੀਜ਼ ਦੱਸ ਦਿੰਦਾ ਸੀ ਵੀ ਉਹ ਚੀਜ਼ ਮੈਂ ਲਿਖ ਨਹੀਂ ਪਾਉਂਦਾ ਸੀਗਾ ਉਹਨੂੰ ਮੈਂ ਬੋਲ ਕੇ ਜਾਂ ਕੰਪਨੀ ਬੋਲ ਦਿੰਦਾ ਸੀ ਉਹਦੇ ਰਿਲੇਟਿਡ ਜਿਹੜਾ ਐਮਾਜੋਨ ਆ ਉਹ ਬਹੁਤ ਚੰਗੇ ਰਿਜਲਟ ਮੈਨੂੰ ਦਿੰਦਾ ਸੀ ਜਿਹਦੇ ਕਰਕੇ ਬੜਾ ਫਾਇਦਾ ਹੁੰਦਾ ਸੀਗਾ ਕਈ ਵਾਰੀ ਕੋਈ ਚੀਜ਼ ਆਪਾਂ ਨੂੰ ਨਹੀਂ ਸਮਝ ਆਉਂਦੀ ਨਹੀਂ ਲਿਖ ਨਹੀਂ ਪਾਉਂਦੇ ਵੀ ਹਾਂ ਯਾਰ ਆਹ ਚੀਜ਼ ਆਪਾਂ ਨਹੀਂ ਲਿਖ ਪਾਏ ਉਹ ਚੀਜ਼ ਦੇ ਵਿੱਚ ਜਿਹੜਾ ਐਮਜੋਨ ਵੋਇਸ ਅਸਿਸਟੈਂਟ ਜਿਹੜਾ ਉਹ ਬਹੁਤ ਕੰਮ ਕਰਦਾ ਆਪਾਂ ਬੋਲ ਕੇ ਕੋਈ ਵੀ ਚੀਜ਼ ਆਪਾਂ ਕੋਈ ਵੀ ਕੰਪਨੀ ਹੈ ਉਹ ਬੋਲ ਦਿੰਦੇ ਹਾਂ ਤਾਂ ਉਸ ਕੰਪਨੀ ਰਿਲੇਟਡ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ ਜੋ ਕਿ ਇੱਕ ਬਹੁਤ ਹੀ ਸੁਖਾਲਾ ਢੰਗ ਹੈ ਕੋਈ ਵੀ ਪ੍ਰੋਡਕਟ ਲੈਣ ਲਈ ਜਾਂ ਕੋਈ ਵੀ ਪ੍ਰੋਡਕਟ ਲੈਣ ਦੇਣ ਦੇ ਵਿੱਚ ਖਰੀਦਣ ਲਈ ਬਹੁਤ ਵਧੀਆ ਚੀਜ਼ ਹੈ ਜੇਕਰ ਆਪਾਂ ਬੋਲ ਕੇ ਜੇਕਰ ਆਪਣਾ ਸਿਸਟਮ ਚੱਲਦਾ ਤਾਂ ਬਹੁਤ ਵਧੀਆ ਉਹ ਚੀਜ਼ ਬਣ ਮੰਨੀ ਜਾਂਦੀ ਹੈ ਜਿਵੇਂ ਵੋਇਸ ਨਿਯੰਤਰਣ ਜਿਹੜਾ ਹੋਮ ਅਸਿਸਟੈਂਟ ਹੈ ਉਹਦੇ ਲਈ ਉਹਦਾ ਅਨੁਭਵ ਮੇਰਾ ਤਾਂ ਬਹੁਤ ਵਧੀਆ ਰਿਹਾ ਹੈ ਕਿਉਂਕਿ ਇਹਦੇ ਇਹਦੇ ਨਾਲ ਮੈਨੂੰ ਜਿਹੜੇ ਵੀ ਪ੍ਰੋਡਕਟ ਮੈਂ ਖਰੀਦਣਾ ਚਾਹੇ ਆ ਉਹ ਮੈਨੂੰ ਸਾਰੇ ਮਿਲ ਮਿਲ ਗਏ ਆ